ਟ੍ਰੈਡਮਿਲ ਇੱਕ ਜਿਮ ਦੀ ਮਸ਼ੀਨ ਹੈ ਇਹ ਜਿਮ ਵਿੱਚ ਮੌਜੂਦ ਹੁੰਦੀ ਹੈ ਅਤੇ ਇਹ ਜਿਮ ਵਿੱਚ ਦੌੜਣ ਲਈ ਇਸਤੇਮਾਲ ਕੀਤੀ ਜਾਂਦੀ ਹੈ ਜਿਵੇਂ ਇਨਸਾਨ ਜਮੀਨ 'ਤੇ ਦੌੜ ਲਾਉਂਦਾ ਹੈ ਉਂਝ ਹੀ ਬ ਇਨਸਾਨ ਟ੍ਰੈ ਇੱਕ ਥਾਂ 'ਤੇ ਖੜੋ ਕੇ ਇੱਕ ਟਾਈਮ 'ਤੇ ਇੱਕ ਥਾਂ 'ਤੇ ਖੜੋ ਕੇ ਉਸ ਟ੍ਰੈਡਮਿਲ 'ਤੇ ਦੌੜ ਲਾਉਂਦਾ ਹੈ ਚਾਹੇ ਜਿੰਨੇ ਮਰਜੀ ਸਪੀਡ 'ਤੇ ਦੌੜ ਲਾ ਲਏ ਉਹ ਇਹ ਟ੍ਰੈਡਮਿਲ ਜਿਮ ਦੇ ਵਿੱਚ ਜਾਂ ਕਈ ਲੋਕਾਂ ਨੇ ਆਪਣੇ ਘਰਾਂ ਵਿੱਚ ਰੱਖੀ ਹੁੰਦੀ ਹੈ ਤਾਂ ਕਿ ਉਹ ਦੌੜ ਦੌੜਦੇ ਰਹਿਣ ਅਤੇ ਉਹਨਾਂ ਦਾ ਸਰੀਰ ਤੰਦਰੁਸਤ ਤਾਕਤਵਰ ਅਤੇ ਫੁਰਤੀਲਾ ਰਹੇ ਟ੍ਰੈਡਮਿਲ ਕਰਨ ਨਾਲ ਸਰੀਰ ਫੁਰਤੀਲਾ ਰਹਿੰਦਾ ਹੈ ਅਤੇ ਸਰੀਰ ਵਿੱਚ ਕਈ ਬਿਮਾਰੀਆਂ ਦਾ ਜਨਮ ਨਹੀਂ ਹੋ ਪਾਉਂਦਾ ਟ੍ਰੈਡਮਿਲ ਇੱਕ ਐਸੀ ਚੀਜ਼ ਹੈ ਜੋ ਟ੍ਰੈਡਮਿਲ ਨੂੰ ਇੱਕ ਐਸੀ ਚੀਜ਼ ਹੈ ਜੋ ਜਿਸ ਦੀ ਵਰਤੋਂ ਕਰਨ ਨਾਲ ਇਨਸਾਨ ਹਮੇਸ਼ਾ ਦੌੜਦਾ ਰਹਿੰਦਾ ਹੈ ਫੁਰਤੀਲਾ ਰਹਿੰਦਾ ਹੈ ਅਤੇ ਬਹੁਤ ਸਾਰੇ ਕੰਮ ਫੁਰਤੀਲੇਪਨ 'ਚ ਕਰ ਦਿੰਦਾ ਹੈ ਟ੍ਰੈਡਮਿਲ 'ਚ ਉਹਨਾਂ ਲੋਕਾਂ ਲਈ ਹੈ ਜਿਹੜੇ ਘਰੋਂ ਬਾਹਰ ਜਾ ਕੇ ਦੌੜ ਨਹੀਂ ਲਾ ਸਕਦੇ ਟ੍ਰੈਡਮਿਲ 'ਤੇ ਜਮੀਨ 'ਤੇ ਦੌੜਨਾ ਸਿਰਫ ਸਮਾਂ ਇੱਕ ਸਮਾਨ ਹੀ ਹੈ ਮਗਰ ਜਮੀਨ 'ਤੇ ਦੌੜਨਾ ਜ਼ਿਆਦਾ ਲਾਭਦਾਇਕ ਆ ਕਿਉਂਕਿ ਉੱਥੇ ਸ ਸਾਫ਼ ਹਵਾ ਜਾਂ ਸਾਫ਼ ਵਾਤਾਵਰਨ ਵੀ ਮਿਲਦਾ ਹੈ ਅਤੇ ਟ੍ਰੈਡਮਿਲ 'ਚ ਉਹ ਨਹੀਂ ਮਿਲਦਾ